ਸਤਿ ਸ਼੍ਰੀ ਅਕਾਲ ਮੇਰਾ ਨਾਮ ਵਾਸੂਦਾ ਹੈ ਅਤੇ ਮੈਂ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਹੁਣ ਆਪਾਂ ਗੱਲ ਕਰੀਏ ਜਿਵੇਂ ਖਬਰਾਂ ਦੀ ਖਬਰਾਂ ਦੀ ਗੱਲ 'ਚ ਆਪਾਂ ਹਕੀਕਤ ਤਾਂ ਆਪਾਂ ਮਤਲਬ ਦੱਸਣਾ ਅੰਤਰ ਕੀ ਵਾਪਰ ਰਹੀਆਂ ਚੀਜ਼ਾਂ ਕੀ ਹੈ ਅਤੇ ਹਕੀਕਤ ਸਾਨੂੰ ਕੀ ਦੱਸਿਆ ਜਾਂਦਾ ਵੈਸੇ ਤਾਂ ਸਾਨੂੰ ਮਤਲਬ ਕੋਈ ਵੀ ਲੇਟੈਸਟ ਨਿਊਜ਼ ਹੋਏ ਤਾਂ ਮਿਲ ਹੀ ਜਾਂਦੀ ਆ ਪਰ ਮਤਲਬ ਕਈ ਲੋਕ ਹੁੰਦੇ ਆ ਇਹੋ ਜਿਹੇ ਜਿਹੜੀ ਇਹ ਚੀਜ਼ਾਂ ਨੂੰ ਮਤਲਬ ਗਲਤ ਤਰ੍ਹਾਂ ਮਤਲਬ ਗਲਤ ਤਰ੍ਹਾਂ ਸਾਨੂੰ ਦੱਸਦੇ ਹੈ ਅਤੇ ਕੋਈ ਮਤਲਬ ਜਿੱਦਾਂ ਖਬਰਾਂ ਕੋਈ ਵਧੀਆ ਖਬਰ ਹੋਏਗੀ ਕਈ ਜਾਣੇ ਹੁਣ ਅੱਜਕੱਲ੍ਹ ਵੈਸੇ ਵੀ ਟੈਕਨੋਲੋਜੀ ਬੜੀ ਵੱਧ ਗਈ ਆ ਕੋਈ ਵੀ ਜਿੱਦਾਂ ਨਿਊਜ਼ ਹੋਏਗੀ ਉਹਨੂੰ ਮਤਲਬ ਜਾਂ ਕੋਈ ਵੀਡੀਓ ਹੋਏਗੀ ਨਿਊਜ਼ ਕੁਛ ਵੀ ਹੋਏਗਾ ਉਹਨੂੰ ਮਤਲਬ ਕੋਈ ਉੱਦਾਂ ਦਾ ਦੱਸੇਗੀ ਕਿ ਲੋਕ ਉਹਨੂੰ ਮਤਲਬ ਕੀ ਹੇਟ ਕਰਨ ਇੱਦਾਂ ਦੀਆਂ ਚੀਜ਼ਾਂ ਬਾਰੇ ਲੋਕ ਕਰ ਦਿੰਦੇ ਅੱਜ ਕੱਲ੍ਹ ਹੋਰ ਸਮਾਜ 'ਤੇ ਇੰਨਾ ਮਤਲਬ ਪ੍ਰਭਾਵ ਪੈਂਦਾ ਕਿ ਹੁਣ ਸਮਝ ਲਉ ਜਿੱਦਾਂ ਕੋਈ ਵੀ ਹੋ ਗਿਆ ਮਤਲਬ ਕੋਈ ਵੀ ਜਿੱਦਾਂ ਜਿੱਦਾਂ ਸਕੂਲ ਹੈ ਸਕੂਲ ਵਿੱਚ ਜਿੱਦਾਂ ਕੋਈ ਮਤਲਬ ਹਾਦਸਾ ਹੋ ਗਿਆ ਅਤੇ ਜਿੱਦਾਂ ਹੁਣ ਕੋਈ ਨਿਊਜ਼ ਨਿਊਜ਼ ਵਾਲੇ ਆਪਣਾ ਮਤਲਬ ਤੜਕਾ ਮਸਾਲਾ ਬਣਾਉਣ ਵਾਸਤੇ ਇੱਦਾਂ ਕਰਦੇ ਕਿ ਸਕੂਲ ਵਿੱਚ ਇੰਨੇ ਟੈਰਿਸਟ ਆ ਗਏ ਇੱਦਾਂ ਉੱਦਾਂ ਮਤਲਬ ਉੱਦਾਂ ਕਿ ਕਿਸੇ ਨੂੰ ਵੀ ਇਫੈਕਟ ਪੈ ਸਕਦਾ ਹੁਣ ਸਾਡੀ ਫੈਮਲੀ ਆ ਹੁਣ ਆਪਾਂ ਸਕੂਲ ਗਏ ਦੇ ਬੱਚੇ ਅਤੇ ਹੁਣ ਆਪਾਂ ਜਦੋਂ ਸਕੂਲ ਗਏ ਦੇ ਬੱਚੇ ਅਤੇ ਉਹਨਾਂ ਨੇ ਕਿਹਾ ਕਿ ਇੱਥੇ ਬੰਬ ਫੱਟ ਗਿਆ ਮਤਲਬ ਬੱਚੇ ਨਹੀਂ ਰਹੇ ਇੱਦਾਂ ਮਤਲਬ ਉਹ ਥੋੜ੍ਹਾ ਉਹ ਕਰਨ ਦੀ ਗਈ ਲੇਟੈਸਟ ਨਿਊਜ਼ 'ਤੇ ਟਰੈਂਡਿੰਗ 'ਚ ਹੋਏ ਨਿਊਜ਼ ਮਤਲਬ ਇੱਦਾਂ ਕਰ ਦਿੰਦੇ ਆ ਬਟ ਉਹਨਾਂ ਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਉਹਦੇ ਨਾਲ ਉਹਨਾਂ ਦੇ ਘਰਦਿਆਂ 'ਤੇ ਕੀ ਇਫੈਕਟ ਪੈਂਦਾ ਉਹ ਕੀ ਮਤਲਬ ਕਾਫੀ ਕੁਝ ਉਹਨਾਂ 'ਤੇ ਇਫੈਕਟ ਹੈ ਹੁਣ ਸਮਾਜ ਸਮਾਜ 'ਤੇ ਕੀ ਪ੍ਰਭਾਵ ਪੈਂਦਾ ਸਮਾਜ 'ਤੇ ਵੀ ਇਹੀ ਗੱਲ ਹੈ ਜਿੱਦਾਂ ਹੁਣ ਆਪਾਂ ਕੋਈ ਚੀਜ਼ ਹੈ ਠੀਕ ਹੈ ਜਿੱਦਾਂ ਆਪਾਂ ਕਿਤੇ ਜਾਣਾ ਜਾਂ ਫਿਰ ਆਪਾਂ ਹਾਂ ਕਿਤੇ ਜਾਣਾ ਅਤੇ ਕੋਈ ਸਾਨੂੰ ਗਲਤ ਚੀਜ਼ ਦੱਸ ਦੇਵੇਗਾ ਕਿ ਇੱਥੇ ਇਹ ਸਭ ਹੈ ਇਹ ਸਭ ਹੈ ਫਿਰ ਆਪਾਂ ਉਹ ਚੀਜ਼ 'ਤੇ ਜਾ ਨਹੀਂ ਪਾਵਾਂਗੇ ਕਿੰਨਾ ਹੀ ਆਪਾਂ ਉਹਨਾਂ ਮਤਲਬ ਦੇਖ ਪਾਵਾਂਗੇ ਕਿ ਕੀ ਆ ਉਹ ਚੀਜ਼ ਅਤੇ ਜੇ ਸਾਨੂੰ ਖਬਰ ਹੀ ਗਲਤ ਮਿਲੇਗੀ ਤਾਂ ਆਪਾਂ ਮਤਲਬ ਉਹਨੂੰ ਸਹੀ ਕਿੱਦਾਂ ਸੋਚਾਂਗੇ ਆਪਾਂ ਸਟਾਰਟਿੰਗ ਤੋਂ ਉਹਦੇ ਵਾਸਤੇ ਗਲਤ ਹੀ ਸੋਚਾਂਗੇ